ਭੰਗੜੇ ਦੇ ਕੁਛ ਆਮ ਸਟੈਪ ਗਿੱਧਾ ਤਾੜੀ ਮਾਰ ਕੇ ਭੰਗੜਾ ਪਾਉਣਾ ਪੱਟ 'ਤੇ ਹ ਹੱਥ ਮਾਰ ਕੇ ਭੰਗੜਾ ਪਾਉਣਾ ਬਾਹਾਂ ਨੂੰ ਖਿਲਾਰ ਕੇ ਭੰਗੜਾ ਪਾਉਣਾ ਫੇਸ 'ਤੇ ਸਮਾਈਲ ਰੱਖ ਕੇ ਭੰਗੜਾ ਪਾਉਣਾ ਜਸ਼ਨ ਵੇਲੇ ਪੂਰੇ ਜ਼ੋਰਦਾਰ ਸੁਭਾਅ ਨਾਲ ਭੰਗੜਾ ਪਾਉਣਾ ਮਤਲਬ ਭੰਗੜਾ ਪਾਉਣ ਸਮੇਂ ਮਤਲਬ ਇੱਦਾਂ ਕੁਛ ਵੀ ਮਤਲਬ ਪਤਾ ਨਹੀਂ ਲੱਗਦਾ ਹੈਗਾ ਵੀ ਕਿੱਦਾਂ ਕਿਵੇਂ ਕੋਈ ਵੀ ਬਦਲੇਗਾ ਆਪਣੇ ਹੀ ਭੰਗੜੇ ਦੇ ਸਟੈਪ ਅਲੱਗ ਵੀ ਹੁੰਦੇ ਹਨ ਇਸ ਵਿੱਚ ਮਤਲਬ ਕੁੜਤਾ ਚਾਦਰਾ ਨੋਕ ਵਾਲੀ ਜੁੱਤੀ ਮਤਲਬ ਹਾਰ ਸ਼ਿੰਗਾਰ ਪੂਰਾ ਲਾ ਕੇ ਪੂਰੇ ਜਸ਼ਨ 'ਚ ਜਸ਼ਨ ਵਾਲੇ ਸੁਭਾਅ 'ਚ ਭੰਗੜਾ ਪਾਉਣਾ ਖੂੰਡਾ ਹੱਥ ਵਿੱਚ ਲੈ ਕੇ ਭੰਗੜਾ ਪਾਉਣਾ ਥਾਪੀ ਪੱਟ 'ਤੇ ਥਾਪੀ ਮਾਰ ਕੇ ਭੰਗੜਾ ਪਾਉਣਾ ਅਸ਼ਕੇ ਵਾਲਾ ਸਟੈਪ ਕਿੱਕਲੀ ਵਾਲਾ ਸਟੈਪ ਬਹੁਤ ਸਾਰੇ ਮਤਲਬ ਭੰਗੜੇ ਦੇ ਸਟੈਪ ਹਨ ਵੀ ਜੋ ਆਪਾਂ ਮਤਲਬ ਹਰ ਇੱਕ ਉਹਦੇ 'ਚ ਕਰ ਸਕਦੇ ਹਾਂ ਭੰਗੜਾ ਸਾਡੇ ਮਤਲਬ ਵੀ ਪੰਜਾਬ ਦੀ ਸ਼ਾਨ ਹੈ ਭੰਗੜਾ ਗੱਭਰੂਆਂ ਦੀ ਸ਼ਾਨ ਹੈ ਭੰਗੜੇ ਨੂੰ ਹਰ ਕੋਈ ਪਾ ਸਕਦਾ ਹੈ ਮੁਟਿਆਰਾਂ ਵੀ ਪਾ ਸਕਦੀਆਂ ਹਨ